ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਆਓ ਜੀ ਆਓ ਜੀ ਇਸ ਏਰੀਏ 'ਚ ਸੋਹਾਣਾ ਸਾਹਿਬ ਚੰਡੀਗੜ੍ਹ ਸੁਖਨਾ ਲੇਕ ਜੀ ਅਤੇ ਹੋਰ ਵੀ ਹਾਂਜੀ ਹਾਂਜੀ ਧਾਰਮਿਕ ਜਗ੍ਹਾ ਜੀ ਹਾਂਜੀ ਸਰ ਜ਼ਰੂਰ ਹਾਂਜੀ ਹਾਂਜੀ ਸਰ ਵਾਹਗਾ ਬਾਡਰ ਵੀ ਹੈ ਨਾਲ ਸਰ ਕਦੋਂ ਆਉਣਾ ਫਿਰ ਤੁਸੀਂ

ਸਰ ਫੈਸੀਲਿਟੀ ਵਧੀਆ ਮਿਲੇਗੀ ਤੁਹਾਨੂੰ ਫਾਈਵ ਸਟਾਰ ਪੂਰੀ ਸਰ ਗੱਡੀ ਦਾ ਅਰੇਂਜਮੈਂਟ ਵਧੀਆ ਏ ਟੂਰਿਸਟ ਬੱਸ ਹੈ ਪੂਰੀ ਏਸੀ ਦਾ ਪੂਰਾ ਪ੍ਰਬੰਧ ਹੈ ਅੰਦਰ ਹਾਂਜੀ ਸਰ ਸਭ ਵਧੀਆ ਏ ਵਨ ਕੰਮ ਹਾਂਜੀ ਸਰ ਗਰਮੀ ਦਾ ਹੈ ਪਰ ਕੋਈ ਚੱਕਰ ਨਹੀਂ ਸਭ ਪੂਰਾ ਅਰੇਜਮੈਂਟ ਮਿਲੇਗਾ ਤੁਹਾਨੂੰ ਸਰ ਉਹ ਫਿਰ ਲੈਂਦੇ ਹੈ ਮਿਲ ਕੇ ਗੱਲ ਕਰ ਲੈਂਦੇ ਸਰ

ਓਕੇ ਸਰ ਥੈਂਕ ਯੂ ਸਰ